ਅਸੀਂ ਅੱਜ ਰਾਜ ਰੈਸਟੋਰੈਂਟ ਦਾ ਜਮੈਟੋ ਦੇ ਰਾਹੀਂ ਆਡਰ ਕੀਤਾ ਸੀ ਪਰ ਉਹ ਆਡਰ ਸਾਡੇ ਘਰ ਆਇਆ ਅਸੀਂ ਉਹ ਭੋਜਨ ਖੋਲ੍ਹਿਆ ਤਾਂ ਭੋਜਨ ਦੇ ਵਿੱਚ ਕਿਸੇ ਤਰ੍ਹਾਂ ਦੀ ਖੁਸ਼ਬੂ ਨਹੀਂ ਸੀ ਬਦਬੂ ਆ ਰਹੀ ਸੀ ਅਤੇ ਸਬਜ਼ੀ ਵੀ ਬਿਲਕੁਲ ਸੁਆਦ ਨਹੀਂ ਸੀ ਇਹਨਾਂ ਨੇ ਸਾਡਾ ਭੋਜਨ ਸਮੇਂ ਸਿਰ ਵੀ ਨਹੀਂ ਪਹੁੰਚਾਇਆ ਸਾਨੂੰ ਤਾਂ ਇੰਝ ਪ੍ਰਤੀਤ ਹੁੰਦਾ ਸੀ ਕਿ ਭੋਜਨ ਵਿੱਚ ਹਲਕੀ ਕਿਸਮ ਦਾ ਘਿਓ ਵਰਤਿਆ ਗਿਆ ਹੈ ਅਤੇ ਸਬਜ਼ੀ ਵੀ ਰਿਫਾਇੰਡ ਦੀ ਬਣੀ ਲੱਗਦੀ ਸੀ ਰੈਸਟੋਰੈਂਟ ਵਿੱਚ ਗਲੇ ਸੜੇ ਟਮਾਟਰ ਵਰਤੇ ਗਏ ਸਨ ਬਦਬੂ ਵਾਲੀ ਜਾਂ ਬਾਸੀ ਚੀਜ਼ ਖਾਣ ਦੇ ਨਾਲ ਕੋਈ ਵੀ ਬਿਮਾਰ ਹੋ ਸਕਦਾ ਹੈ ਅਤੇ ਖਾਣ ਵਾਲੇ ਵਾਸਤੇ ਇਹ ਭੋਜਨ ਹਾਨੀਕਾਰਕ ਹੈ ਜੋਮੈਟੋ ਵਾਲਿਆਂ ਦੀ ਡਿਲੀਵਰੀ ਸੇਵਾਵਾਂ ਵੀ ਚੰਗੀਆਂ ਨਹੀਂ ਸੀ ਅਸੀਂ ਜਮੈਟੋ ਦੇ ਅਧਿਕਾਰੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਆਡਰ ਦਾ ਕੀਤਾ ਹੋਇਆ ਭੋਜਨ ਜਾਂ ਤਾਂ ਪੈਸਾ ਰਿਫੰਡ ਕਰ ਦਿਓ ਜਾਂ ਭੋਜਨ ਬਦਲੀ ਕਰਕੇ ਭੇਜੋ